ਰਸੋਈ ਵਿੱਚ ਅਸੀਂ ਹਰ ਤਰ੍ਹਾਂ ਦਾ ਭਾਂਡਾ ਵਰਤਦੇ ਹਾਂ ਇੱਕ ਕੁੱਕਰ ਵਰਤਦੇ ਹਾਂ ਸਬਜ਼ੀ ਬਣਾਉਣ ਲਈ ਪਤੀਲੇ ਵਰਤਦੇ ਹਾਂ ਦੁੱਧ ਕਰਨ ਲਈ ਅਤੇ ਗਲਾਸ ਚਾਹ ਦੁੱਧ ਪੀਣ ਲਈ ਪਾਣੀ ਪੀਣ ਲਈ ਕੌਲੀਆਂ ਹਰ ਹਰ ਇੱਕ ਚੀਜ਼ ਸਬਜ਼ੀ ਦਾਲ਼ਾਂ ਵਗੈਰਾ ਖਾਣ ਨੂੰ ਕੰਮ ਆਉਂਦੀਆਂ ਜੀ ਥਾਲ਼ੀ ਰੋਟੀ ਪਕਾ ਖਾਣ ਨੂੰ ਕੰਮ ਆਉਂਦੀ ਹੈ ਪਲੇਟਾਂ ਵੀ ਕੰਮ ਆਉਂਦੀਆਂ ਏ ਕੜਛੀ ਬਣਾਉਣ ਨੂੰ ਸਬਜ਼ੀ ਦੇ ਅਤੇ ਫਰਾਈਬੀਨ ਆਉਂਦੇ ਹੈ ਪੂੜੇ ਬਣਾਉਣ ਲਈ ਆਮਲੇਟ ਬਣਾਉਣ ਲਈ ਅਤੇ ਬਸ